ਸ਼ੇਅਰ ਮਾਰਕਿਟ ਦੇ ਬਾਰੇ ਮੈਂ ਜਾਣਦਾ ਹਾਂ ਜਿਹੜਾ ਉਤਰਾਅ ਅਤੇ ਚੜ੍ਹਾਅ ਇਹੋ ਹੀ ਇਸ ਬਜ਼ਾਰ ਦਾ ਸਾਰਾ ਕੁਝ ਹੈ ਜਿਹੜਾ ਬਜ਼ਾਰ ਹੈ ਉਤਰਾਅ ਅਤੇ ਚੜ੍ਹਾਅ ਦੇ ਉੱਤੇ ਹੀ ਨਿਰਭਰ ਕਰਦਾ ਹੈ ਜਿਹੜਾ ਲਾਭ ਅਤੇ ਹਾਨੀ ਹੈ ਉਸਦਾ ਦੂਜਾ ਨਾਮ ਹੀ ਉਤਰਾਅ ਅਤੇ ਚੜ੍ਹਾਅ ਹੈ ਇਸ ਚੀਜ਼ ਨੂੰ ਸਿੱਖਣ ਤੋਂ ਬਿਨ੍ਹਾਂ ਜੇਕਰ ਆਪਾਂ ਕਰਾਂਗੇ ਤਾਂ ਉਸਨੂੰ ਆਪਾਂ ਖ਼ਤਰਨਾਕ ਮੰਨਾਗੇ ਉਹ ਖ਼ਤਰਨਾਕ ਕਿਉਂ ਮੰਨਾਗੇ ਕਿਉਂਕਿ ਬਿਨ੍ਹਾਂ ਸਿੱਖਣ ਤੋਂ ਆਪਾਂ ਆਪਣੇ ਜਿੰਨ੍ਹੇ ਪੈਸੇ ਨੇ ਉੱਥੇ ਇੰਨਵੈਸਟ ਕੀਤੇ ਉਹ ਆਪਾਂ ਖੋ ਸਕਦੇ ਹਾਂ ਲੇਕਿਨ ਜੇਕਰ ਅਸੀਂ ਇਸ ਚੀਜ਼ ਨੂੰ ਬੜੇ ਹੀ ਧਿਆਨ ਦੇ ਨਾਲ਼ ਬੜੇ ਹੀ ਵਧੀਆ ਸਮਾਂ ਲਗਾ ਕੇ ਸਿੱਖਿਆ ਜਾਵੇ ਤਾਂ ਜਿਹੜਾ ਇਹ ਬਜ਼ਾਰ ਹੈ ਬਹੁਤ ਹੀ ਵਧੀਆ ਚੀਜ਼ ਹੈ ਅੱਜ ਕੱਲ੍ਹ ਜਿਵੇਂ ਦੁਨੀਆਂ ਦੇ ਉੱਤੇ ਮੰਦੀ ਛਾ ਚੁੱਕੀ ਹੈ ਜਿਹੜੀ ਬੇਰੁਜ਼ਗਾਰੀ ਹੈ ਉਹ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਵਿੱਚ ਹੀ ਲੋਕ ਇਸ ਚੀਜ਼ ਦੇ ਨਾਲ ਜੂਝਦੇ ਜਾ ਰਹੇ ਨੇ ਆਹ ਹੁਣ ਦੋ ਚਾਰ ਦਿਨ ਹੋ ਗਏ ਕਨੇਡਾ ਨੇ ਵੀ ਆਪਣੇ ਜਿਹੜੇ ਦਰਵਾਜ਼ੇ ਹੈ ਉਹ ਪੰਜ ਸਾਲ ਦੇ ਲਈ ਬੰਦ ਕਰ ਦਿੱਤੇ ਨੇ ਉੱਥੇ ਬੇਰੁਜ਼ਗਾਰੀ ਦਾ ਆਲਮ ਵੱਧ ਚੁੱਕਿਆ ਲੇਕਿਨ ਇਸਦੇ ਇਸਦਾ ਜਿਹੜਾ ਬੇਰੁਜ਼ਗਾਰੀ ਦਾ ਇਵਜ਼ ਕੀ ਹੈ ਇਸਦੇ ਇਵਜ਼ ਦੇ ਵਿੱਚ ਸਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਮਾਰਕਿਟ ਬਾਰੇ ਸ਼ੇਅਰ ਮਾਰਕਿਟ ਦੇ ਬਾਰੇ ਜਾਂ ਕੋਈ ਵੀ ਦੁਨੀਆਂ ਦੇ ਅੰਦਰ ਕਈ ਮਾਰਕਿਟਾਂ ਨੇ ਕ੍ਰਿਪਟੋ ਦੀ ਮਾਰਕਿਟ ਹੈ ਠੀਕ ਹੈ ਜੀ ਅਤੇ ਜਿਹੜਾ ਸ਼ੇਅਰ ਮਾਰਕਿਟ ਹੈ ਇਹਨਾਂ ਚੀਜ਼ਾਂ ਨੂੰ ਸਾਨੂੰ ਸਿੱਖਣਾ ਚਾਹੀਦਾ ਜਿਹੜਾ ਇਹ ਸਕਿੱਲਮੈਂਟ ਹੈ ਇਹ ਮੇਰੇ ਹਿਸਾਬ ਦੇ ਨਾਲ਼ ਤਾਂ ਸਾਨੂੰ ਸਾਡੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਇਹ ਇਹੋ ਜਿਹੀ ਚੀਜ਼ ਹੈ ਜਿਹੜੀ ਅਸੀਂ ਘਰ ਬੈਠ ਕੇ ਆਪਣੇ ਹੱਥਾਂ ਦੇ ਨਾਲ਼ ਆਪਣਾ ਦਿਮਾਗ ਵਰਤ ਕੇ ਪੈਸੇ ਬਣਾ ਸਕਦੇ ਹਾਂ ਰੋਜ਼ ਦੀ ਰੋਜ਼ ਲੇਕਿਨ ਵੱਡੇ ਮੈਂ ਦੁੱਖ ਨਾਲ਼ ਇਹ ਕਹਾਂਗਾ ਵੀ ਸਾਡੇ ਲੋਕ ਨੇ ਜਿਹੜੇ ਇਸ ਚੀਜ਼ ਦੇ ਵੱਲ ਬਹੁਤ ਘੱਟ ਜਾਂ ਬੱਚਿਆਂ ਨੂੰ ਬਹੁਤ ਘੱਟ ਤੋਰਦੇ ਨੇ ਪਰੰਤੂ ਜਿਹੜੇ ਬੰਦੇ ਇਸ ਸੈਕਟਰ ਦੇ ਵਿੱਚ ਹਨ ਉਹ ਕੁਝ ਕੁ ਦਿਨਾਂ ਬਾਅਦ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਇੱਥੇ ਪੈਸਾ ਕਿਵੇਂ ਬਣਦਾ ਅਤੇ ਕਿਵੇਂ ਖੋ ਹੁੰਦਾ ਹਰ ਇੱਕ ਚੀਜ਼ ਨੂੰ ਸਿੱਖਣਾ ਪੈਂਦਾ ਹੈ ਸਿੱਖਣ ਦੇ ਲਈ ਥੋੜ੍ਹਾ ਜਿਹਾ ਸਮਾਂ ਦਿਉ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਵਧੀਆ ਨੇ ਪੋਜ਼ੀਟਿਵ ਨੇ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਦਾ ਹੋਰ ਵੀ ਖ਼ਤਰਾ ਬਹੁਤ ਜ਼ਿਆਦਾ ਜਿਹੜਾ ਮੰਡਰਾ ਰਿਹਾ ਉਹ ਵਧਦਾ ਹੀ ਜਾ ਰਿਹਾ ਅਤੇ ਆਬਾਦੀ ਵਧਦੀ ਜਾ ਰਹੀ ਹੈ ਨੌਕਰੀਆਂ ਘੱਟਦੀਆਂ ਜਾ ਰਹੀਆਂ ਨੇ ਅਤੇ ਇਹੋ ਜਿਹੇ ਸਮੇਂ ਦੇ ਵਿੱਚ ਆਪਾਂ ਕੀ ਕਰਾਂਗੇ ਇਹੋ ਸਮੇਂ ਜਿਹੇ ਸਮੇਂ ਦੇ ਵਿੱਚ ਅਸੀਂ ਇਹੋਂ ਜਿਹੀ ਚੀਜ਼ਾਂ ਨੇ ਸ਼ੇਅਰ ਮਾਰਕਿਟ ਵਗੈਰਾ ਹੋ ਗਈ ਜੋ ਵੀ ਮਾਰਕਿਟਸ ਨੇ ਉਹਨਾਂ ਬਾਰੇ ਸਾਨੂੰ ਨੋਲ਼ੇਜ ਲੈ ਕੇ ਘਰ ਬੈਠ ਕੇ ਹੀ ਇਹ ਜਿਹੜਾ ਕੰਮ ਹੈ ਉਹ ਕਰ ਲੈਣਾ ਚਾਹੀਦਾ ਹੈ